ਸਾਡੇ ਇਲਾਕੇ ਵਿੱਚ ਹੈ ਵਧੀਆ ਜਗ੍ਹਾ ਘੁੰਮਣ ਵਾਸਤੇ ਜਿੱਥੇ ਬੰਦਾ ਯਾਤਰਾ ਕਰ ਸਕਦਾ ਏ ਜਿਸ ਤਰ੍ਹਾਂ ਕਿ ਮੋਹਾਲੀ ਸ਼ਹਿਰ ਵਧੀਆ ਘੁੰਮਣ ਨੂੰ ਦੋ ਚਾਰ ਥਾਵਾਂ ਉੱਥੇ ਵਧੀਆ ਦੇਖਣ ਯੋਗ ਹੈਗੀਆਂ ਬਾਕੀ ਆਪਣੇ ਲਾਗ ਏ ਹਿਮਾਲਿਆ ਦੀ ਗੋਦ ਵਿੱਚ ਸਿਸਮਾ ਡੈਮ ਉੱਥੇ ਬੋਟਿੰਗ ਬੁਟਿੰਗ ਕਰ ਲੈਂਦੇ ਹਾਂ ਜਾ ਕੇ ਉਹ ਵਧੀਆ ਇੱਕ ਵਧੀਆ ਚੀਜ਼ ਹੈ ਸਾਡੇ ਲਾਗੇ ਚੰਡੀਗੜ੍ਹ ਜੋ ਰਾਜਧਾਨੀ ਹੈ ਉੱਥੇ ਵੀ ਵਧੀਆ ਜਾ ਕੇ ਘੁੰਮਣ ਦਾ ਇਲਾਕਾ ਵਧੀਆ ਏ ਬਾਕੀ ਥੋੜ੍ਹੇ ਬਹੁਤ ਧਾਰਮਿਕ ਸਥਾਨ ਹੈ ਜਿੱਥੇ ਤੁਸੀਂ ਯਾਤਰਾ ਕਰ ਸਕਦੇ ਹੋ ਬਾਕੀ ਠੀਕ ਹੈ ਸਾਰਾ ਕੁਛ ਵਧੀਆ ਏ ਉੱਥੇ ਲੋਕਾਂ ਨੂੰ ਜਾ ਕੇ ਸਕੂਨ ਮਿਲਦਾ ਏ ਕੋਈ ਵੀ ਹੈ ਆਪਾਂ ਜਾ ਕੇ ਜਿੱਥੇ ਯਾਤਰਾ ਕਰਦੇ ਹਾਂ ਉਹ ਕਿਸੇ ਸਕੂਨ ਵਾਸਤੇ ਹੀ ਜਾਂਦੇ ਹਾਂ ਇਸ ਕਰਕੇ ਉੱਥੇ ਦੀ ਯਾਤਰਾ ਕੀਤੀ ਜਾਂਦੀ ਹੈ